ਹੈਲੋ ਹਾਂਜੀ ਮੈਂ ਇੱਕ ਰਿਸਰਚਰ ਬੋਲਣਦੀ ਹਾਂ ਅਤੇ ਮੈਨੂੰ ਭਾ ਇਹ ਪੁੱਛਣਾ ਸੀ ਕਿ ਪੰਜਾਬ ਦੇ ਇੰਡੀਆ ਦੇ ਇਕੋਨਮੀ ਦੇ ਵਿੱਚ ਕੀ ਰੋਲ ਹੈ ਅਤੇ ਖੇਤੀਬਾੜੀ 'ਚ ਕੀ ਕੀ ਪੰਜਾਬ ਕੀ ਕੀ ਉਗਾਉਂਦਾ ਕਿੱਥੇ ਕਿੱਥੇ ਤੱਕ ਜਾਂਦੇ ਆ ਇਹਨਾਂ ਦੇ ਟਰਾਂਸਫਰਿੰਗ ਜੀ ਠੀਕ ਹੈ ਅਤੇ ਇੱਥੇ ਟੂਰਿਸਟ